ਸੰਗੀਤ ਸੰਗੀਤ ਹਰ ਕਿਸੇ ਦੇ ਮਨ ਨੂੰ ਮੋਹ ਲੈਂਦਾ ਹੈ ਸੰਗੀਤ ਦੋ ਵਿਅਕਤੀਆਂ ਨੂੰ ਜੋੜਦਾ ਹੈ ਸੰਗੀਤ ਸਾਡੇ ਇਕੱਲੇਪਣ ਨੂੰ ਦੂਰ ਕਰਦਾ ਹੈ ਸੰਗੀਤ ਹਰ ਇੱਕ ਅਜਿਹੀ ਡੋਰ ਹੈ ਜੋ ਹਰ ਕਿਸੇ ਨੂੰ ਬੰਨ ਕੇ ਰੱਖਣ ਵਿੱਚ ਕੰਮ ਆਉਂਦੀ ਹੈ ਸੰਗੀਤ ਸਾਡੇ ਮਨ ਨੂੰ ਸ਼ਾਂਤ ਕਰਦਾ ਹੈ ਇਸ ਕਰਕੇ ਸੰਗੀਤ ਦਾ ਚੰਗਾ ਹੋਣਾ ਬਹੁਤ ਜ਼ਰੂਰੀ ਹੈ ਜਦੋਂ ਅਸੀਂ ਧੀਮੇ ਲਹਿਜੇ ਨਾਲ ਸ਼ੁਰੂ ਕਰਦੇ ਹਾਂ ਔਰ ਫਿਰ ਇੱਕ ਉੱਚੀ ਆਵਾਜ਼ ਵਿੱਚ ਗਾਉਂਦੇ ਹਾਂ ਤਾਂ ਉਹ ਇਕ ਬੜੀ ਹੀ ਪਿਆਰੀ ਧੁੰਨ ਜਿਹੀ ਬਣ ਜਾਂਦੀ ਹੈ ਜਿਸ ਨਾਲ ਸਾਨੂੰ ਚੰਗਾ ਸੰਗੀਤ ਮਿਲਦਾ ਹੈ ਇਸ ਕਰਕੇ ਹੀ ਸਾਨੂੰ ਆਪਣੇ ਹਾਵ ਭਾਵ ਆਪਣੇ ਹੱਥਾਂ ਦੇ ਭਾਵਾਂ ਨੂੰ ਜਾਂ ਆਪਣੇ ਚਿਹਰੇ ਦੀ ਮੁਸਕਾਨ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ ਅਕਸਰ ਹੀ ਜਦੋਂ ਵੀ ਮੈਂ ਗੀਤ ਗਾਉਂਦੀ ਹਾਂ ਤਾਂ ਉਸ ਵਿੱਚ ਧਿਆਨ ਰੱਖਦੀ ਹਾਂ ਕਿ ਨਾ ਹੀ ਤਾਂ ਕੋਈ ਚੀਜ਼ ਜ਼ਿਆਦਾ ਕੀਤੀ ਜਾਵੇ ਨਾ ਕੋਈ ਘੱਟ ਜ਼ਿਆਦਾਤਰ ਸੰਗੀਤਾਂ ਵਿੱਚ ਅਸੀਂ ਆਪਣੇ ਹੱਥਾਂ ਦੇ ਬਹੁਤ ਹਾਵ ਭਾਵ ਕਰਦੇ ਹਾਂ ਜਿੱਦਾਂ ਕਿ ਕੋਈ ਮੁਦਰਾ ਬਣਾਉਣਾ ਜਾਂ ਫਿਰ ਕਿਸੇ ਉੱਚੇ ਸੁਰ ਦੇ ਵੇਲੇ ਉਸਨੂੰ ਹੂੰ ਇੱਕ ਗੰਠ ਜਿਹੇ 'ਚ ਬੰਨ ਲੈਣਾ ਇਸੇ ਦੇ ਨਾਲ ਨਾਲ ਗਾਉਣ ਵੇਲਿਆਂ ਚਿਹਰੇ 'ਤੇ ਮੁਸਕਾਨ ਹੋਣੀ ਚਾਹੀਦੀ ਹੈ ਅਤੇ ਬਹੁਤ ਸਾਰੇ ਗਾਇਕ ਗਾਇਕਾ ਗਾਉਂਦੇ ਵੇਲਿਆਂ ਆਪਣੀ ਅੱਖਾਂ ਬੰਦ ਰੱ ਬੰਦ ਰੱਖਦੇ ਹਨ ਮੇਰਾ ਵੀ ਕੁਛ ਅਜਿਹਾ ਹੀ ਹੈ ਮੈਂ ਵੀ ਗਾਉਣ ਵੇਲਿਆਂ ਅਕਸਰ ਆਪਣੀਆਂ ਅੱਖਾਂ ਬੰਦ ਕਰ ਲੈਂਦੀ ਹਾਂ ਪਰੰਤੂ ਕੁਛ ਲੋਕ ਅੱਖਾਂ ਖੋਲ ਕੇ ਵੀ ਗਾ ਲੈਂਦੇ ਹਨ ਇਹ ਜ਼ਰੂਰੀ ਨਹੀਂ ਕਿ ਤੁਹਾਡੇ ਹਾਵ ਭਾਵ ਮਿਲਣ ਜਦੋਂ ਤੁਸੀਂ ਗਾਣਾ ਗਾ ਰਹੇ ਹੋ ਹਰ ਕੋਈ ਅਲੱਗ ਅਲੱਗ ਤਰੀਕੇ ਨਾਲ ਗਾਉਂਦਾ ਹੈ ਜਦੋਂ ਕਿ ਤੁਸੀਂ ਇੱਕ ਚੰਗੇ ਗਾਣੇ ਨੂੰ ਖੁਸ਼ੀ ਦੇ ਨਾਲ ਗਾਓ ਤਾਂ ਉਹ ਇੱਕ ਲਹਿਰ ਜਿਹੀ ਬਰ ਬਣ ਜਾਂਦੀ ਹੈ ਉਹ ਤਰੰਗ ਹਰ ਕਿਸੇ ਦੇ ਵਿੱਚ ਉੱਠਦੀ ਹੈ ਜੋ ਵੀ ਤੁਹਾਡੇ ਲਾਗੇ ਬੈਠੇ ਹਾਂ ਤੁਹਾਡੀ ਆਵਾਜ਼ ਨੂੰ ਸੁਣ ਰਿਹਾ ਹੈ ਉਸਦੀ ਖੁਸ਼ੀ ਝਲਕ ਉੱਠਦੀ ਹੈ ਜਦੋਂ ਅਸੀਂ ਕੋਈ ਦੁੱਖ ਭਰਿਆ ਗਾਣਾ ਗਾ ਰਹੇ ਹੁੰਦੇ ਹਾਂ ਤਾਂ ਉਦੋਂ ਵੀ ਸਾਡੇ ਹਾਵ ਭਾਵ ਅਜਿਹੇ ਹੋਣੇ ਚਾਹੀਦੇ ਹੈ ਕਿ ਉਹ ਗਾਣੇ ਦੇ ਨਾਲ ਮਿਲ ਜਾਣ ਤਾਂ ਹੀ ਉਹ ਉਸ ਗਾਣੇ ਨੂੰ ਸੂਟ ਕਰ ਜਾਂਦੇ ਹਨ ਪਰੰਤੂ ਜੇ ਅਸੀਂ ਗਾ ਇੱਕ ਖੁਸ਼ੀ ਵਾਲਾ ਗਾਣਾ ਰਹੇ ਹਾਂ ਅਤੇ ਅਗਰ ਸਾਡੇ ਚਿਹਰੇ 'ਤੇ ਹਾਵ ਭਾਵ ਦੁੱਖ ਜਿਹੇ ਹਨ ਤਾਂ ਉਹ ਚੰਗਾ ਨਹੀਂ ਲੱਗਦਾ ਅਗਲੇ ਬੰਦੇ ਨੂੰ ਵੀ ਲੱਗਦਾ ਹੈ ਕਿ ਅਸੀਂ ਮਨ ਨਾਲ ਨਹੀਂ ਗਾ ਰਹੇ ਇਸ ਕਰਕੇ ਭਾਵੇਂ ਸਾਡੀ ਆਵਾਜ਼ ਚੰਗੀ ਵੀ ਹੋਵੇ ਤਾਂ ਉਹ ਚੀਜ਼ ਚੰਗੀ ਨਹੀਂ ਲੱਗਦੀ ਉਸਨੂੰ ਇਸ ਗੱਲ ਦਾ ਆਭਾਸ ਹੋ ਰਿਹਾ ਹੁੰਦਾ ਹੈ ਕਿ ਇਹ ਸੰਗੀਤ ਉਸਦੇ ਅੰਦਰੋਂ ਨਹੀਂ ਨਿਕਲ ਰਿਹਾ ਇਸ ਲਈ ਪ੍ਰਦਰਸ਼ਨ ਦੇ ਵੇਲਿਆਂ ਆਪਣੀ ਰੁਚੀ ਨੂੰ ਪੇਸ਼ ਕਰਨ ਲਈ ਤੁਹਾਨੂੰ ਖੁਸ਼ ਹੋ ਕੇ ਕਰਨਾ ਚਾਹੀਦਾ ਹੈ ਜਦੋਂ ਵੀ ਮੈਂ ਗਾਣਾ ਗਾਉਂਦੀ ਹਾਂ ਤਾਂ ਮੈਂ ਹਮੇਸ਼ਾ ਪਹਿਲਾਂ ਕੁਛ ਸੋਚ ਰਹੀ ਹੁੰਦੀ ਹਾਂ ਅਤੇ ਉਸਦੇ ਨਾਲ ਹੀ ਮੇਰੇ ਹਾਵ ਭਾਵ ਬਣ ਜਾਂਦੇ ਹਨ ਜ਼ਿਆਦਾਤਰ ਸਮੇਂ ਗਾਉਣਾ ਵੀ ਉਸਦੇ ਹਿਸਾਬ ਨਾਲ ਹੀ ਹੁੰਦਾ ਹੈ ਪਰੰਤੂ ਜੇ ਤੁਹਾਨੂੰ ਕਿਸੇ ਦੇ ਸਾਹਮਣੇ ਜਿੱਦਾਂ ਕਿ ਕਿਸੀ ਸਟੇਜ 'ਤੇ ਜਾਂ ਫਿਰ ਕਿਸੇ ਇਸ ਤਰ੍ਹਾਂ ਗਾਣਾ ਗਾਉਣ ਦੀ ਲੋੜ ਪਏ ਆਵਸ਼ਕਤਾ ਹੋਏ ਉਦੋਂ ਤੁਹਾਨੂੰ ਚੰਗੀ ਤਰ੍ਹਾਂ ਸੋਚ ਸਮਝ ਕੇ ਆਪਣੇ ਆਪ ਨੂੰ ਪ੍ਰੀਪੇਅਰ ਕਰਕੇ ਗਾਉਣਾ ਚਾਹੀਦਾ ਹੈ ਇਸ ਕਰਕੇ ਹੀ ਤੁਹਾਡੀ ਜੋ ਰੁਚੀ ਹੈ ਉਹ ਸਾਰਿਆਂ ਦੇ ਸਾਹਮਣੇ ਆ ਸਕਦੀ ਹੈ ਜਦੋਂ ਵੀ ਅਸੀਂ ਸਟੇਜ 'ਤੇ ਪਰਫੋਰਮ ਕਰਦੇ ਹਾਂ ਤਾਂ ਕਈ ਵਾਰ ਅਸੀਂ ਸਿਰਫ ਗਾਉਣਾ ਗਾਉਂਦੇ ਹਾਂ ਉਸ ਵੇਲੇ ਸਾਡੇ ਜਿਹੜੇ ਮੁੱ ਮੁੱਖ 'ਤੇ ਖੁਸ਼ੀ ਹੋਣੀ ਚਾਹੀਦੀ ਹੈ ਇੱਕ ਲਹਿਰ ਹੋਣੀ ਚਾਹੀਦੀ ਹੈ ਤਾਂ ਕਿ ਹਰ ਕਿਸੇ ਤੱਕ ਸਾਡਾ ਗਾਣਾ ਖੁਸ਼ੀ ਖੁਸ਼ੀ ਪਹੁੰਚ ਪਾਏ ਸਾਡੀ ਆਵਾਜ਼ ਉਸਦੇ ਦਿ ਦਿਲ ਵਿੱਚ ਵੱਸ ਜਾਏ ਅਤੇ ਹਰ ਕੋਈ ਸਾਨੂੰ ਸੁਣਨਾ ਚਾਹੇ ਤਾਂ ਇਸ ਤਰ੍ਹਾਂ ਕਈ ਵਾਰ ਅਸੀਂ ਕੁਛ ਵਜਾਉਣ ਵਾਲੀ ਚੀਜ਼ਾਂ ਵੀ ਆਪਣੇ ਨਾਲ ਰੱਖ ਲੈਂਦੇ ਹਾਂ ਉਸਦੇ ਨਾਲ ਅਸੀਂ ਉਸ ਗਾਉਣ ਦੇ ਨਾਲ ਨਾਲ ਅਸੀਂ ਉਸ ਵਿੱਚ ਸੰਗੀਤ ਵੀ ਆਪ ਦੇ ਸਕਦੇ ਹਾਂ ਸੰਗੀਤ ਵਜਾਉਣ ਦੇ ਸੰਗੀਤ ਵਜਾਉਣ ਦੇ ਵੀ ਕਈ ਕਾਰਣ ਹੁੰਦੇ ਹਨ ਕਈ ਲੋਕਾਂ ਨੂੰ ਸੰਗੀਤ ਪਸੰਦ ਹੁੰਦਾ ਹੈ ਪਰ ਗਾਉਣਾ ਨਹੀਂ ਉਹ ਫਿਰ ਕੁਛ ਵਜਾ ਕੇ ਜਿੱਦਾਂ ਕਿ ਪੀਆਨੋ ਜਾਂ ਗਿਟਾਰ ਵਜਾ ਕੇ ਆਪਣੀ ਰੁਚੀ ਨੂੰ ਪੂਰਾ ਕਰ ਲੈਂਦੇ ਹਨ ਅਕਸਰ ਦੋਵਾਂ ਦਾ ਮੇਲ ਵੀ ਬਹੁਤ ਸੋਹਣਾ ਲੱਗਦਾ ਹੈ ਕਈ ਵਾਰ ਇੱਕ ਬੰਦਾ ਜੋ ਗਾ ਰਿਹਾ ਹੁੰਦਾ ਹੈ ਔਰ ਇੱਕ ਜੋ ਵਜਾ ਰਿਹਾ ਹੁੰਦਾ ਹੈ ਉਹਨਾਂ ਦਾ ਮੇਲ ਵੀ ਬਹੁਤ ਸੋਹਣਾ ਲੱਗਦਾ ਹੈ ਇੱਦਾਂ ਹੀ ਹਰ ਕਿਸੇ ਦੀ ਰੁਚੀ ਸਾਹਮਣੇ ਆ ਸਕਦੀ ਹੈ ਤਾਂ ਕਈ ਵਾਰ ਇਹਨਾਂ ਦੀ ਵਜ੍ਹਾ ਨਾਲ ਕਈ ਦੋਸਤੀਆਂ ਵੀ ਹੁੰਦੀਆਂ ਹਨ ਇਸ ਤਰ੍ਹਾਂ ਇਹ ਲੋਕਾਂ ਵਿੱਚ ਭਾਈਚਾਰਾ ਵੀ ਵਧਾ ਰਿਹਾ ਹੈ ਤਾਂ ਕਰਕੇ ਸਾਨੂੰ ਪ੍ਰਦਰਸ਼ਨ ਕਰਦੇ ਸਮੇਂ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ ਜਾਂ ਫਿਰ ਸੰਗੀਤ ਦੇ ਹਿਸਾਬ ਨਾਲ ਆਪਣੇ ਹਾਵ ਭਾਵ ਰੱਖਣੇ ਚਾਹੀਦੇ ਹਨ ਤਾਂ ਕਿ ਕਿਸੇ ਨੂੰ ਵੀ ਸਾਡਾ ਕੁਛ ਸੁਣ ਕੇ ਬੁਰਾ ਨਾ ਲੱਗੇ ਸਾਨੂੰ ਆਪਣੇ ਆਪ ਨੂੰ ਵੀ ਇੱਦਾਂ ਦਾ ਨਾ ਲੱਗੇ ਕਿ ਅਸੀਂ ਸਿਰਫ਼ ਗਾਉਣ ਲਈ ਗਾ ਰਹੇ ਹਾਂ ਸਾਨੂੰ ਇੱਦਾਂ ਲੱਗੇ ਕਿ ਸਾਡੇ ਅੰਦਰੋਂ ਦੀ ਇੱਕ ਆਵਾਜ਼ ਇੱਕ ਤਰੰਗ ਨਿਕਲ ਰਹੀ ਹੈ ਜੋ ਕਿ ਸਾਡੇ ਸੰਗੀਤ ਦੀ ਰੁਚੀ ਨੂੰ ਪ੍ਰਭਾਵ ਕਰ ਰਹੀ ਹੈ